ਸਤਿ ਸ਼੍ਰੀ ਅਕਾਲ ਜੀ ਹਾਂਜੀ ਨਾ ਅਸੀਂ ਨਾ ਟੈਕਸੀ ਬੁੱਕ ਕਰਾਈ ਸੀ ਤੁਹਾਡੇ ਕੋਲੋਂ ਹਾਂਜੀ ਤੁਹਾਨੂੰ ਕਿਹਾ ਸੀ ਤੁਸੀਂ ਘੰਟੇ ਤੱਕ ਭੇਜ ਦਿਓ ਤੁਸੀਂ ਭਾਅ ਜੀ ਭੇਜੀ ਨਹੀਂ ਹਲੀ ਡਰਾਇਵਰ ਨੂੰ ਪੁੱਛੋ ਕਿੱਥੇ ਹੈਗਾ ਆ ਵਾ ਅਸੀਂ ਨਾ ਤੁਹਾਡੀ ਵੈਕੈਂਸੀ ਟੈਕਸੀ ਕੈਂਸਲ ਕਰਦੇ ਪਏ ਹਾਂ ਜਿਹੜੇ ਤੁਹਾਨੂੰ ਪੈਸੇ ਦਿੱਤੇ ਆ ਸਾਨੂੰ ਵਾਪਸ ਕਰ ਦਿਉ ਫਿਰ ਅਸੀਂ ਤਾਂ ਕਿ ਹੋਰ ਕੋਈ ਟੈਕਸੀ ਬੁੱਕ ਕਰਾ ਸਕੀਏ ਹਾਂਜੀ ਧੰਨਵਾਦ ਜੀ